ਹਾਂਜੀ ਸਾਡੇ ਇੱਥੇ ਸ਼ਹਿਰ ਦੇ ਵਿੱਚ ਮੇਰੇ ਘਰ ਦੇ ਬਿਲਕੁਲ ਨੇੜੇ ਹੀ ਕਲਾ ਸਪਲਾਈ ਸਟੋਰ ਹੈ ਜਿਸ ਦੇ ਵਿੱਚ ਮੈਨੂੰ ਕਿ ਨਿਯਮਿਤ ਤੌਰ 'ਤੇ ਜੋ ਵੀ ਮੈਂ ਇੱਥੋ ਚੀਜ਼ਾਂ ਖਰੀਦਦੀ ਹਾਂ ਉਹ ਸਭ ਕੁਛ ਮੈਨੂੰ ਜੋ ਮੈਂ ਚਾਹੁੰਦੀ ਹਾਂ ਉਹ ਸਭ ਕੁਛ ਹੀ ਉਪਲਬਧ ਹੋ ਜਾਂਦਾ ਹੈ ਔਰ ਮਤਲਬ ਕੋਈ ਜ਼ਿਆਦਾ ਉਸਦੇ ਲਈ ਕੁਛ ਮਿਹਨਤ ਨਹੀਂ ਕਰਨੀ ਪੈਂਦੀ ਜੋ ਵੀ ਅਸੀਂ ਉੱਥੇ ਮੰਗ ਕਰਦੇ ਹਾਂ ਉਹ ਮਿਲ ਜਾਂਦਾ ਹੈ